ਕੱਲ੍ਹ ਸ਼ਾਮ ਪੰਜ ਵਜੇ ਮੈਂ ਸਵੀਗੀ ਵੈੱਬਸਾਈਟ ਤੋਂ ਆਪਣਾ ਭੋਜਨ ਦਾ ਆਰਡਰ ਦਿੱਤਾ ਜਿਸ ਵਿੱਚ ਇੱਕ ਬਰਗਰ ਇੱਕ ਕੋਲਡ ਡਰਿੰਕ ਅਤੇ ਇੱਕ ਸੈਂਡਵਿਚ ਸ਼ਾਮਿਲ ਸੀ ਇਹਨਾਂ ਦਾ ਟੋਟਲ ਰੁਪਏ ਡੇਢ ਸੌ ਰੁਪਏ ਬਣੇ ਅਤੇ ਮੈਂ ਅਤੇ ਜਦੋਂ ਆਰਡਰ ਆਇਆ ਤਾਂ ਮੈਂ ਔਨਲਾਇਨ ਪੇਮੈਂਟ ਕਰ ਚੁੱਕਿਆ ਸੀ ਜੋ ਕਿ ਪਹਿਲੀ ਵਾਰੀ ਵਿੱਚ ਨੈੱਟਵਰਕ ਪ੍ਰੋਬਲਮ ਕਾਰਨ ਸਫ਼ਲ ਨਹੀਂ ਹੋ ਸਕੀ ਤਾਂ ਜੋ ਮੈਂ ਦੂਸਰੀ ਵਾਰੀ ਦੁਬਾਰਾ ਟਰਾਈ ਕੀਤੀ ਅਤੇ ਪੇਮੈਂਟ ਹੋ ਗਈ ਪਰੰਤੂ ਜਦੋਂ ਮੈਂ ਦੁਬਾਰਾ ਦੇਖਣਾ ਚਾਹਿਆ ਤਾਂ ਫਿਰ ਮੈਂ ਸਵੀਗੀ ਦੀ ਵੈੱਬਸਾਈਟ ਦੇ ਉੱਤੇ ਗਿਆ ਅਤੇ ਭੁਗਤਾਨ ਸ਼ੈਲੀ ਵਿੱਚ ਜਾ ਕੇ ਆਪਣਾ ਆਰਡਰ ਚੈੱਕ ਕੀਤਾ ਜਿਸ ਵਿੱਚ ਮੇਰਾ ਆਰਡਰ ਕੰਪਲੀਟ ਹੋ ਚੁੱਕਿਆ ਸੀ